ਹੈਲੋ ਹਾਂਜੀ ਬੋਲੋ ਸਤਿ ਸ਼੍ਰੀ ਅਕਾਲ ਜੀ ਵੀਰੇ ਹਾਂਜੀ ਬੋਲੋ ਹਾਂਜੀ ਹਾਂ ਕੋਈ ਨਹੀਂ ਜੇ ਤੁਹਾਡਾ ਜਰੂਰੀ ਕੋਈ ਕੰਮ ਹੈ ਫਿਰ ਲਗਾ ਦਾਂਗੇ ਵੈਸੇ ਮੈਨੂੰ ਨਾ ਘਰੇ ਬਈ ਹੋਰ ਇੱਕ ਦੋ ਘਰਾਂ ਵੀ ਕੰਮ ਕਰਨਾ ਹੁੰਦਾ ਮੇਰੀ ਨਾ ਨਾਨਣ ਨੇ ਵੀ ਆਪਦੇ ਮੁੰਡੇ ਦੀ ਸਗਾਈ ਰੱਖੀ ਉਹਨਾਂ ਨੇ ਤਾਂ ਕੋਈ ਨਹੀਂ ਸ਼ਾਮ ਦਾ ਕੋਈ ਨੀ ਜੇ ਤੁਹਾਡਾ ਜਿਆਦਾ ਜਰੂਰੀ ਕੰਮ ਹੈ ਨਾ ਉਹ ਮੈਂ ਕਰਾ ਦਾਂਗੀ ਜਿਵੇਂ ਖਾਣਾ ਲਵਾਂਗੀ ਵੈਸੇ ਵੀ ਹੋ ਹਾਂਜੀ ਵੈਸੇ ਵੀ ਠੰਡ ਦਾ ਟਾਈਮ ਹੈਗਾ ਤੇ ਫਿਰ ਥੋੜਾ ਲੇਟ ਹੀ ਹੋ ਜਾਂਦਾ ਮੇਰੇ ਕੋਲ ਫਿਰ ਆਪ ਕੇ ਵੀ ਕਰਨਾ ਹੁੰਦਾ ਕੰਮ

ਹਾਂਜੀ ਅੱਛਾ ਜੀ ਜੀ ਉਹ ਤਾਂ ਕੋਈ ਨਹੀਂ ਪੇਮੈਂਟ ਦੀ ਗੱਲ ਤਾਂ ਨਹੀਂ ਕੋਈ ਉਹ ਤਾਂ ਚਲੋ ਆਪਣਾ ਸਮਝ ਕੇ ਕੋਈ ਕਰ ਦਿੰਦਾ ਹੁੰਦਾ ਕੰਮ ਕੋਈ ਨਹੀਂ ਤੁਹਾਡੇ ਨਾਲ ਕਰਾ ਲਾਂਗੇ ਕੰਮ ਜੇ ਤੁਹਾਡੇ ਗੈਸਟ ਆ ਰਹੇ ਨੇ ਦੋ ਕੋਈ ਨਹੀਂ ਮੈਂ ਕਰਾ ਦਾਂਗੀ ਕੰਮ ਫਿਰ ਕੋਈ ਨਾ ਦੋ ਬੱਚੇ ਵੀ ਫਿਰ ਸਕੂਲ ਤੋਂ ਵੀ ਆਏ ਉਹਨਾਂ ਨੂੰ ਖਾਣਾ ਖੁਣਾ ਬਨਾਣਾ ਹੁੰਦਾ ਨਾ ਟਾਈਮ ਕੱਢ ਕੇ ਕੋਈ ਨਹੀਂ ਤੁਹਾਡੇ ਕੋਲ ਫਿਰ ਤੁਹਾਡਾ ਜਿਆਦਾ ਜਰੂਰੀ ਕੰਮ ਉਹ ਕਰਾ ਦਾਂਗੇ ਅੱਛਾ ਹਾਂਜੀ ਹਾਂਜੀ ਕੋਈ ਨਹੀਂ ਮੈਨੂੰ ਟਾਈਮ ਮੈਂ ਕੱਢ ਤਾ ਤੁਹਾਡਾ ਵੀ ਕਰਾ ਦਾਂਗੀ ਤੇ ਫਿਰ ਵੇਖ ਲਾਂਗੀ ਤੇ ਨਾਲੇ ਨਾ ਕੋਈ ਨਹੀਂ ਨਨਾਣ ਹੀ ਮੇਰੀ ਕੱਲੀ ਹੈਗੀ ਨਾ ਉਹਦੇ ਕੋਲ ਵੀ ਕੰਮ ਨਹੀਂ ਹੁੰਦਾ ਫਿਰ ਕੱਲੇ ਹੈਗੇ ਨਾ ਸਮਾਨ ਲਿਆਣ ਵਾਲਾ ਵੀ ਕੋਈ ਨਹੀਂ ਹੈਗਾ ਤੇ ਮੈਂ ਉਹਨਾਂ ਦਾ ਵੀ ਫਿਰ ਕੰਮ ਕਰਨਾ ਹੁੰਦਾ ਉਹਨਾਂ ਦੇ ਘਰ ਵਾਲੇ ਦਾ ਵੀ ਆਪਰੇਸ਼ਨ ਹੋਇਆ ਨਾ ਫਿਰ ਕੱਲੀ ਪਰੇਸ਼ਾਨ ਹੋ ਜਾਂਦੇ ਨੇ ਕੰਮ ਕਰਦੇ ਹੋਏ ਤੇ ਸਾਰੇ ਕਰਨਾ ਪੈਂਦਾ ਉਹਨਾਂ ਦੀ ਤਬੀਅਤ ਵੀ ਫਿਰ ਐਵੇਂ ਹੀ ਰਹਿੰਦੀ ਹੈਗੀ ਆ ਹਾਂਜੀ ਹਾਂਜੀ ਕੋਈ ਨਹੀਂ ਤੁਸੀਂ ਚਿੰਤਾ ਨਾ ਕਰੋ ਤੇ ਮੈਂ ਤੁਹਾਡਾ ਸਮਾ ਖਾਣ ਪੀਣ ਦਾ ਸਾਰਾ ਕੰਮ ਕੋਈ ਨਹੀਂ ਕਰਾ ਦਾਂਗੇ ਤੁਸੀਂ ਵੈਸੇ ਸਮਾਨ ਲੈ ਆਏ ਸਾਰਾ ਘਰਤਾ ਸਾਰਾ ਬਣਾਣ ਦਾ

ਵੈਸੇ ਮੈਂ ਪੁੱਛ ਰਹੀ ਸੀ ਤੁਹਾਡੇ ਅਗਰ ਕੋਈ ਫੰਕਸ਼ਨ ਜਾਂ ਪਾਰਟੀ ਵਗੈਰਾ ਹੈਗੀ ਤਾਂ ਤੁਸੀਂ ਮੈਨੂੰ ਕਹਿੰਦੇ ਕਿ ਉਹ ਕੰਮ ਵਾਸਤੇ ਹਾਂਜੀ ਅੱਛਾ ਠੀਕ ਹੈ ਹਾਂਜੀ ਵੈਸੇ ਜਿਆਦਾ ਠੰਡ ਨਾ ਹੋਈ ਤਾਂ ਮੈਂ ਕੋਈ ਨਹੀਂ ਤੁਹਾਡਾ ਕੰਮ ਕਰਾ ਦਾਂਗੇ ਸਵੇਰੇ ਟਾਈਮ ਤਿੰਨ ਤੋਂ ਪੰਜ ਦਾ ਟਾਈਮ ਹੈ ਮੈਂ ਆ ਜਾਗੀ ਕੋਈ ਨਹੀਂ ਤੁਹਾਡਾ ਜੋ ਤੁਹਾਡਾ ਜਿਆਦਾਜਰੂਰੀ ਨਾ ਪਹਿਲਾਂ ਉਹ ਤੁਹਾਡਾ ਕੰਮ ਕਰਾ ਦਾਂਗੀ ਮੈਂ ਤੁਹਾਡੇ ਘਰੇ ਵੀ ਫੰਕਸ਼ਨ ਹੈਗਾ ਹਾਂਜੀ ਹਾਂ ਇੰਨਾ ਤਾਂ ਟਾਈਮ ਹੋ ਹੀ ਜਾਂਦਾ ਅੱਛਾ ਜੀ ਹਾਂ ਕੋਈ ਨਹੀਂ ਤੁਸੀਂ ਫਿਕਰ ਨਾ ਕਰੋ ਕੋਈ ਨਹੀਂ ਤੁਹਾਡਾ ਕੰਮ ਵੀ ਹੋ ਜਾਏਗਾ ਤੇ ਕਰਾ ਦਾਂਗੇ ਕੋਈ ਨਹੀਂ ਆਪਣਾ ਸਮਝ ਕੇ ਵੀ ਬੰਦਾ ਕਰਾ ਦਿੰਦਾ ਹੁੰਦਾ ਕੰਮ ਚੱਲ ਤੁਹਾਡੇ ਵੀ ਹੈਲਪ ਹੋ ਜਾਏਗੀ ਨਾਲ ਤੇ ਉਹਨਾਂ ਦਾ ਮੇਰੇ ਨਨਾਣ ਹੋਰਾਂ ਦਾ ਵੀ ਹੋ ਜਾਏਗਾ ਕੰਮ ਉਹਨਾਂ ਦਾ ਕੋਈ ਨਹੀਂ ਮੈਂ ਸ਼ਾਮ ਤੱਕ ਚਲੇ ਜਾਊਂਗੀ ਹਾਂਜੀ ਹੋਰ ਹੋਰ ਅੱਛਾ ਠੀਕ ਹ ਜੀ ਕੋਈ ਮੈਨੂੰ ਹੋਰ ਨਾਲ ਮਿਲੀ ਨਾ ਮੇਰੀ ਜਾਨ ਪਹਿਚਾਣ ਦੀ ਤੋ ਕੋਈ ਨਹੀਂ ਤੁਹਾਡੀ ਉਹਨੂੰ ਵੀ ਨਾਲ ਲੈ ਆਵਾਂਗੀ ਤਾਂ ਕੋਈ ਨਹੀਂ ਥਾਡਾ ਕੰਮ ਥਾਡਾ ਕੰਮ ਵੀ ਜਲਦੀ ਨਿਬੜ ਜਾਏਗਾ ਤੁਸੀਂ ਜਲਦੀ ਫ੍ਰੀ ਹੋ ਜਾਓਗੇ ਹਾਂਜੀ ਓਕੇ ਹਾਂ ਮੈਂ ਫੋਨ ਕਰਦਾ